ਹੈਲੋ ਸਰ ਮੈਂ ਆਰਤੀ ਮੇਰਾ ਨਾਮ ਆਰਤੀ ਸਤਿ ਸ਼੍ਰੀ ਅਕਾਲ ਸਰ ਮੈਂ ਆਪਣੀ ਸੱਭਿਆਚਾਰ ਵਿਚਾਰ ਨੂੰ ਸੰਭਾਲਣ ਦੇ ਤੁਹਾਡੇ ਨਾਲ ਕੁਝ ਸਾਂਝਾ ਕਰਨਾ ਚਾਹੁੰਦੀ ਹਾਂ ਜਿਸ ਤਰ੍ਹਾਂ ਕਿ ਸਾਡੇ ਇੱਥੇ ਪੰਜਾਬ ਵਿੱਚ ਘੁੰਮਣ ਲਈ ਅੰਮ੍ਰਿਤਸਰ ਅੰਮ੍ਰਿਤਸਰ ਵਿੱਚ ਗੋਲਡਨ ਟੈਂਪਲ ਜਲਿਆਂਵਾਲਾ ਜਿਸ ਤਰ੍ਹਾਂ ਪਠਾਨਕੋਟ ਵਿੱਚ ਘੁੰਮਣ ਲਈ ਮੰਦਰ ਗੁਰਦੁਆਰੇ ਸਭ ਕੁਛ ਹੈ ਇੱਥੇ ਔਰ ਜਿਸ ਤਰ੍ਹਾਂ ਖਾਣੇ ਦੀ ਗੱਲ ਕੀਤੀ ਜਾਏ ਖਾਣੇ ਵਿੱਚ ਸਾਡੇ ਪੰਜਾਬ 'ਚ ਸਾਗ ਢੋਡਾ ਲੱਸੀ ਅਤੇ ਔਰ ਪਹਿਨਾਵੇ ਵਿੱਚ ਜਿਸ ਤਰ੍ਹਾਂ ਮੁੰਡਿਆਂ ਨੂੰ ਸ਼ਾਦੀ ਵਿਆਹ ਵਿੱਚ ਕੁੜਤਾ ਪਜਾਮਾ ਪਸੰਦ ਹੈ ਭੰਗੜਾ ਕੁੜਤਾ ਪਜਾਮਾ ਔਰ ਕੁੜੀਆਂ ਨੂੰ ਸਲਵਾਰ ਕਮੀਜ਼ ਪਸੰਦ ਹੈ ਜਿਸ ਤਰ੍ਹਾਂ ਸਾਡਾ ਸੱਭਿਆਚਾਰ ਜਿਸ ਦਿਨ ਕੋਈ ਫੰਕਸ਼ਨ ਹੋਏ ਬੱਚਿਆਂ ਨੂੰ ਪਸੰਦ ਹੁੰਦਾ ਭੰਗੜਾ ਕੁੜੀਆਂ ਨੂੰ ਗਿੱਧਾ ਔਰ ਵੀ ਸਭ ਕੁਛ ਦੱਸਣਾ ਚਾਹੁੰਦੀ ਹਾਂ ਕਿ ਪੰਜਾਬ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਦਾ ਮਾਹੌਲ ਹੈ ਇਸ ਤਰ੍ਹਾਂ ਪੰਜਾਬ ਨੂੰ ਮਨਾਇਆ ਜਾਂਦਾ ਹੈ